ਉੱਤਰੀ ਭਾਰਤ ਅਤੇ ਦੱਖਣੀ ਭਾਰਤ ਦੇ ਸੱਭਿਆਚਾਰ ਵਿੱਚ ਬਹੁਤ ਅੰਤਰ ਹੈ ਗੱਲ ਕੀਤੀ ਜਾਵੇ ਭਾਸ਼ਾ ਦੀ ਤਾਂ ਉੱਤਰ ਭਾਰਤ ਦੇ ਵਿੱਚ ਹਿੰਦੀ ਭਾਸ਼ਾ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਅਤੇ ਦੱਖਣੀ ਭਾਰਤ ਦੇ ਵਿੱਚ ਤਮਿਲ ਤੇਲਗੂ ਭਾਸ਼ਾ ਦੀ ਜ਼ਿਆਦਾ ਪ੍ਰਯੋਗ ਕੀਤਾ ਜਾਂਦਾ ਹੈ ਭੋਜਨ ਦੇ ਵਿਸ਼ੇ ਵਿੱਚ ਉੱਤਰੀ ਭਾਰਤ ਵੱਲ ਚਾਵਲ ਕਣਕ ਅਤੇ ਮੱਕੀ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਦੱਖਣ ਭਾਰਤ ਦੇ ਵਿੱਚ ਸਮੁੰਦਰ ਹੋਣ ਦੇ ਕਾਰਨ ਸਮੁੰਦਰੀ ਖਾਣਾ ਜਿਵੇਂ ਕਿ ਮੱਛਲੀ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ ਗੱਲ ਕੀਤੀ ਜਾਵੇ ਅਗਰ ਕੱਪੜੇ ਦੀ ਤਾਂ ਦੱਖਣੀ ਭਾਰਤ ਵੱਲ ਜ਼ਿਆਦਾ ਗਰਮੀ ਹੋਣ ਦੇ ਕਾਰਨ ਲੋਕ ਖੁੱਲ੍ਹੇ ਡੁੱਲੇ ਅਤੇ ਰੇਸ਼ਮੀ ਕੱਪੜੇ ਵੱਧ ਵਰਤਦੇ ਹਨ ਅਤੇ ਉੱਤਰੀ ਭਾਰਤ ਵੱਲ ਗਰਮੀ ਅਤੇ ਸਰਦੀ ਦੋਵੇਂ ਮੌਸਮ ਆਉਂਦੇ ਹਨ ਅਤੇ ਲੋਕ ਗਰਮ ਅਤੇ ਠੰਡੇ ਦੋਨੇ ਕੱਪੜੇ ਪਹਿ ਪਹਿਨਦੇ ਹਨ